ਮੇਰੇ ਅਕੋਰਡਿੰਗ ਜਦੋਂ ਵਿਆਹ ਹੁੰਦਾ ਹੈ ਤਾਂ ਸਾਰਿਆਂ ਨੂੰ ਬਹੁਤ ਖੁਸ਼ੀ ਹੁੰਦੀ ਹੈ ਅਤੇ ਵਿਆਹ ਇੱਕ ਇਹੋ ਜਿਹੀ ਚੀਜ਼ ਹੈ ਸਾਰੇ ਜਣੇ ਰਲ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ ਪਰ ਕੋਈ ਕੋਈ ਸਫਾਈ ਦਾ ਧਿਆਨ ਨਹੀਂ ਰੱਖਦਾ ਬਟ ਕੋਈ ਪਾਣੀ ਦਾ ਧਿਆਨ ਨਹੀਂ ਰੱਖਦਾ ਪਾਣੀ ਇੱਕ ਅਜਿਹੀ ਚੀਜ਼ ਹੈ ਜਿਹਦੇ ਜਿਸ ਦੀ ਵਰਤੋਂ ਜੇ ਸਹੀ ਢੰਗ ਨਾਲ ਹੋਣ 'ਤੇ ਆਪਣਾ ਜੀਵਨ ਸੰਤੁਲਨ ਸਹੀ ਢੰਗ ਨਾਲ ਜਜ ਜੀਵਨ ਅਸੀਂ ਬਤੀਤ ਕਰ ਸਕਦੇ ਹਨ ਜੇ ਪਾਣੀ ਨਾ ਹੋਵੇ ਸਾਡਾ ਜੀਵਨ ਵਿਅਰਥ ਹੈ ਇਸੇ ਤਰ੍ਹਾਂ ਵਿਆਹ ਵਿਆਹਾਂ ਵਿੱਚ ਵੀ ਬਹੁਤ ਪਾਣੀ ਦੀ ਵ ਦੁਰਵਰਤੋਂ ਹੁੰਦੀ ਹੈ ਪਰ ਜਦੋਂ ਵੀ ਸਾਡੇ ਘਰ ਵਿਆਹ ਹੁੰਦਾ ਹੈ ਪਰ ਅਸੀਂ ਵਿਆਹ ਚ ਵਿੱਚ ਹਰ ਚੀਜ਼ ਦੀ ਸੰਭਾਲ ਰੱਖਦੇ ਹਨ ਅਸੀਂ ਤਾਂ ਸਭ ਤੋਂ ਮੁੱਖ ਕਾਰਨ ਅਸੀਂ ਪਹਿਲਾਂ ਪਾਣੀ ਦੀ ਵਰਤੋਂ ਨੂੰ ਦੇਖਦੇ ਹਨ ਕਿੰਨੀ ਲੋੜ ਹੈ ਕਿਨ ਕਿੰਨੇ ਸੇਵਨ ਕਰਦੇ ਹਨ ਜੇ ਅਸੀਂ ਉਸ ਨੂੰ ਦੁਰਉਪਯੋਗ ਵੀ ਨਹੀਂ ਕਰਦੇ ਪਾਣੀ ਅਸੀਂ ਇੱਦਾਂ ਵਗਾਉਂਦੇ ਹਾਂ ਜਿੱਦਾਂ ਕਿ ਪਹਿਲੇ ਦੁਕਾਨ ਦੁਕਾਨਾਂ 'ਤੇ ਗਏ ਦੇਖੇ ਕੁਝ ਕੋਈ ਪਲਾਸਟਿਕ ਦੀ ਵਰਤੋਂ ਉਹਦੇ 'ਚ ਘੱਟ ਹੋਵੇ ਬੋਤਲਾਂ ਹੋਣ ਪਾਣੀ ਦੀਆਂ ਜੇ ਬੋਤਲਾਂ ਹੋਵੇ ਤਾਂ ਕਿਹ ਕਿੱਦਾਂ ਦਾ ਮਟੀਰੀਅਲ ਉਹਨਾਂ ਨੂੰ ਲੱਗਾ ਹੋਵੇ ਇਹ ਚੀਜ਼ ਨੂੰ ਬ ਮੱਦੇਨਜ਼ਰ ਕਰਦੇ ਹੋਏ ਅਸੀਂ ਪਾਣੀ ਦੀ ਵਰਤੋਂ ਨੂੰ ਦੇਖਦੇ ਹਨ ਜੇ ਪਾਣੀ ਸਹੀ ਕੁਆਲਿਟੀ ਦਾ ਹੋਵੇ ਤਾਂ ਅਸੀਂ ਉਸ ਦੀਆਂ ਪੇਟੀਆਂ ਹੋਲਸੇਲ ਵਿੱਚੋਂ ਚੱਕ ਕੇ ਅਸੀਂ ਆਪਣੇ ਵਿਆਹਾਂ ਸ਼ਾਦੀਆਂ ਵਿੱਚ ਯੂਜ਼ ਕਰਦੇ ਹਨ ਜਿਸ ਕਰਕੇ ਸਾਨੂੰ ਪਾਣੀ ਦੀ ਵਰਤੋਂ ਸਹੀ ਢੰਗ ਨਾਲ ਕਰਨੀ ਚਾਹੀਦੀ ਹੈ